ਪੰਜਾਬ ਖੇਤੀਬਾੜੀ ਵਿਭਿੰਨਤਾ ਦਿਸ਼ਾ ਪ੍ਰੋਜੈਕਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੁਆਰਾ ਸ਼ੁਰੂ ਕੀਤਾ ਗਿਆ ਇੱਕ ਖੇਤੀਬਾੜੀ ਪ੍ਰੋਜੈਕਟ ਸੀ ਜੋ ਕਿ ਪੰਜਾਬ ਵਿੱਚ ਪੰਜਾਬ ਦੇ ਪਾਣੀ ਦਾ ਲੇਵਲ ਨੀਵਾਂ ਹੁੰਦਾ ਜਾ ਰਿਹਾ ਉਸ ਨੂੰ ਲੈ ਕੇ ਇਹ ਪ੍ਰੋਜੈਕਟ ਬਣਾਇਆ ਗਿਆ ਸੀ ਜੋ ਕਿ ਪੰਜਾਬ ਵਿੱਚ ਫ਼ਸਲਾਂ ਦੀ ਵਿਭਿੰਨਤਾ ਨੂੰ ਉਤਸਾਹ ਕਰਨ ਲਈ ਬਣਾਇਆ ਗਿਆ ਸੀ ਇਸ ਵਿੱਚ ਭਗਵੰਤ ਮਾਨ ਜੀ ਦੁਆਰਾ ਕਿਹਾ ਗਿਆ ਸੀ ਕਿ ਝੋਨੇ ਦੀ ਫ਼ਸਲ ਨੂੰ ਬਦਲ ਕੇ ਕਪਾਹ ਨਰਮਾ ਦੀ ਖੇਤੀ ਕੀਤੀ ਜਾਵੇ ਤਾਂ ਜੋ ਪੰਜਾਬ ਦਾ ਪਾਣੀ ਉੱਪਰ ਆ ਸਕੇ ਇਸ ਲਈ ਸੀ ਐਮ ਮਾਨ ਨੇ ਇਸ ਵਾਸਤੇ ਸਤਾਰ੍ਹਾਂ ਕਰੋੜ ਕਿਸਾਨਾਂ ਦੇ ਖਾਤੇ ਵਿੱਚ ਪਾਇਆ ਸੀ